ਜੇ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਫਤਿਹਗੜ੍ਹ ਸਾਹਿਬ ਦੀ ਤਾਂ ਇੱਥੇ ਸਾਡੇ ਗੁਰਦੁਆਰੇ ਫਤਿਹਗੜ੍ਹ ਸਾਹਿਬ ਇੱਕ ਧਾਰਮਿਕ ਅਸਥਾਨ ਹੈ ਜੋ ਕਿ ਬਹੁਤ ਮਸ਼ਹੂਰ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਹਰ ਸਾਲ ਪੱਚੀ ਛੱਬੀ ਸਤਾਈ ਦਸੰਬਰ ਨੂੰ ਜਾਂ ਦੇਸੀ ਮਹੀਨਿਆਂ ਦੀ ਬਾਰ੍ਹਾਂ ਤੇਰ੍ਹਾਂ ਚੌਦ੍ਹਾਂ ਪੋਹ ਨੂੰ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਜਦੋਂ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਉਸ ਤਿੰਨ ਦਿਨਾਂ ਦੇ ਦੌਰਾਨ ਆਉਣ ਜਾਣ ਵਾਲੀ ਸੰਗਤ ਲਈ ਬਹੁਤ ਸਾਰੇ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਪ੍ਰਸ਼ਾਸਨ ਵੱਲੋਂ ਰੈਗੂਲਰ ਟਰੈਫਿਕ ਵੀ ਡਾਇਵਰਟ ਕੀਤੀ ਜਾਂਦੀ ਹੈ ਬਾਹਰ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਗੱਡੀਆਂ ਲਈ ਟੈਂਪਰੇਰੀ ਪਾਰਕਿੰਗ ਵੀ ਬਣਾਈ ਜਾਂਦੀ ਹੈ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਬਹੁਤ ਰਸ਼ ਹੋਣ ਕਰਕੇ ਕੋਈ ਵੀ ਗੱਡੀ ਜਾਂ ਵਹੀਕਲ ਨੂੰ ਦੋ ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਣ ਨਹੀਂ ਦਿੱਤਾ ਜਾਂਦਾ